ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਕੋਪਨੀ ਦਾ ਮੋਬਾਈਲ ਖਰੀਦਿਆ ਸੀ ਅਤੇ ਇਹ ਬਹੁਤ ਜ਼ਿਆਦਾ ਲੇਟ ਪਹੁੰਚਿਆ ਅਤੇ ਇਹਦੀ ਇਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਇਸਦੀ ਸਕਰੀਨ ਵੀ ਸਕ੍ਰੈਚ ਹੋਏ ਪਏ ਹੋਏ ਸੀਗੇ ਅਤੇ ਇਸਦੀ ਅਵਾਜ਼ ਬਿਲਕੁਲ ਨਹੀਂ ਆ ਰਹੀ ਹੈਗੀ ਅਤੇ ਇਸਦੀ ਕਲੈਰਟੀ ਕੈਮਰਾ ਕੁਛ ਵੀ ਵਧੀਆ ਨਹੀਂ ਚੱਲ ਰਿਹਾ ਹੈਗਾ ਮੈਨੂੰ ਇਹ ਬਹੁਤ ਨਾਪਸੰਦ ਆਇਆ ਜੀ